ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਕਈ ਪ੍ਰਕਾਰ ਦੀਆਂ ਕੰਪਨੀਆਂ ਹਨ ਜੋ ਕਿ ਕਈ ਲੋਕਾਂ ਨੂੰ ਬਹੁਤ ਹੀ ਕਾਰੋਬਾਰ ਪ੍ਰੋਵਾਈਡ ਕਰਦੀਆਂ ਹਨ ਅਤੇ ਇਹਨਾਂ ਵਿੱਚ ਜਿਵੇਂ ਕਿ ਚੀਮਾ ਬੋਇਲਰ ਬਹੁਤ ਤਕੜੀ ਕੰਪਨੀ ਹੈ ਅਤੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਰੁਜ਼ਗਾਰ ਦਿੱਤਾ ਹੋਇਆ ਹੈ ਉੱਥੇ ਵੀ ਬਹੁਤ ਸਪੇਅਰ ਪਾਰਟ ਤਿਆਰ ਹੁੰਦੇ ਹਨ ਇੱਕ ਹੋਰ ਕੰਪਨੀ ਵੱਡੀ ਹੈ ਜਿਸਦਾ ਨਾਮ ਸਵਰਾਜ ਮਾਜ਼ਦਾ ਹੈ ਉੱਥੇ ਸਵਰਾਜ ਟਰੈਕਟਰਾਂ ਦੇ ਸਪੇਅਰ ਪਾਰਟ ਤਿਆਰ ਕੀਤੇ ਜਾਂਦੇ ਹਨ ਅਤੇ ਹੋਰ ਵੀ ਬਥੇਰੀਆਂ ਕੰਪਨੀਆਂ ਜਿਵੇਂ ਕਿ ਆਲਕਮਿਸਟ ਜਿੱਥੇ ਕਿ ਮੁਰਗਿਆਂ ਨੂੰ ਵੱਢਿਆ ਜਾਂਦਾ ਹੈ ਅਤੇ ਵੱਖ ਵੱਖ ਥਾਵਾਂ 'ਤੇ ਉਸਨੂੰ ਪਹੁੰਚਾਇਆ ਜਾਂਦਾ ਹੈ ਅਤੇ ਜੋ ਕਿ ਅੱਜ ਕੱਲ ਨਵਾਂ ਦੌਰ ਚੱਲ ਰਿਹਾ ਹੈ ਬੱਚੇ ਬਾਹਰ ਨੂੰ ਜਾ ਰਹੇ ਹਨ ਅਤੇ ਆਈਲੈਟਸ ਸੈਂਟਰ ਵੀ ਬਹੁਤ ਖੁੱਲ੍ਹੇ ਹੋਏ ਹਨ ਅਤੇ ਲੋਕ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ ਨੂੰ ਸਿੱਖ ਰਹੇ ਹਨ ਅਤੇ ਉਹਨਾਂ ਦੇ ਟੈਸਟ ਦਿੰਦੇ ਹਨ ਅਤੇ ਬਾਹਰ ਨੂੰ ਜਾਂਦੇ ਹਨ ਜੋ ਕਿ ਅੱਜ ਕੱਲ੍ਹ ਦਾ ਦੌਰ ਚੱਲ ਰਿਹਾ ਹੈ ਅਤੇ ਹੋਰ ਵੀ ਕਾਰੋਬਾਰ ਜਿਵੇਂ ਕਿ ਯੂਟੀਊਬਿੰਗ ਹੋ ਗਈ ਬਲੌਗਿੰਗ ਹੋ ਗਈ ਅੱਜ ਕੱਲ੍ਹ ਦੇ ਬੱਚੇ ਇਸਨੂੰ ਅਪਣਾ ਰਹੇ ਹਨ ਅਤੇ ਆਪਣੇ ਆਪ ਨੂੰ ਇੱਕ ਮੁਕਾਮ 'ਤੇ ਪੁਜਾ ਰਹੇ ਹਨ ਅਤੇ ਆਪਣੇ ਘਰਦਿਆਂ ਦਾ ਨਾਂ ਰੋਸ਼ਨ ਕਰ ਰਹੇ ਹਨ